ਭਾਰਤ ਦਾ ਇਤਿਹਾਸ ਕੀ ਹੈ ਭਾਰਤ ਦਾ ਇਤਿਹਾਸ ਉੱਨੀ ਸੌ ਸੰਤਾਲੀ ਤੋਂ ਪਹਿਲੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਔਰ ਲੋਕੀ ਦੱਬੇ ਕੁੱਚਲੇ ਲੋਕ ਉਹਨਾਂ ਦੇ ਅਧੀਨ ਕੰਮ ਕਰਦੇ ਰਹਿੰਦੇ ਸਨ ਅਤੇ ਜਦੋਂ ਸਾਨੂੰ ਉੱਨੀ ਸੌ ਸੰਤਾਲੀ ਦੇ ਵਿੱਚ ਰਾਜ ਮ ਭਾਰਤ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਸਾਡੀ ਜਿਹੜੀ ਮਨ ਆਈਆਂ ਖੁੱਲ੍ਹੀਆਂ ਆਪਣੀਆਂ ਕੰਮ ਕਾਰ ਦੇ ਵਿੱਚ ਆਜ਼ਾਦੀ ਹੋ ਗਈ ਹੁਣ ਪਹਿਲੇ ਸਾਨੂੰ ਕੋਈ ਵੱਡੀ ਅਹੁਦਾ ਨਹੀਂ ਮਿਲਦਾ ਸੀਗਾ ਹੁਣ ਅਸੀਂ ਪੜ੍ਹਾਈ ਲਿਖਾਈ ਕਰਕੇ ਆਪਣੇ ਆਪ ਉੱਚੇ ਅਹੁਦਿਆਂ ਦਾ ਮਾਣ ਕਰਦੇ ਹਾਂ ਅਤੇ ਇਹਨਾਂ ਦੇ ਵਿੱਚ ਮਾਣ ਦੇ ਵਿੱਚ ਸਾਡੇ ਲੋਕ ਅੱਗੇ ਨੂੰ ਅੱਗੇ ਤਰੱਕੀ ਕਰਦੇ ਨੇ ਅਤੇ ਹੁਣ ਜਿਹੜੇ ਸੁਤੰਤਰ ਅੰਦੋਲਨ ਦੇ ਵਿੱਚ ਬੰਦਿਆਂ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਜਿਨ੍ਹਾਂ ਨੇ ਜਾਨਾਂ ਵਾਰੀਆਂ ਅਤੇ ਲੋਕਾਂ ਦੇ ਹੱਕ ਲਈ ਆਪਣੇ ਧਰਨੇ ਦਿੱਤੇ ਅਤੇ ਲੋਕਾਂ ਦੇ ਨਾਲ਼ ਇਕੱਠੇ ਹੋ ਕੇ ਏਕਤਾ ਦਿਖਾਈ ਅਤੇ ਹੁਣ ਜਿਹੜੇ ਚੱਲ ਰਹੇ ਨੇ ਜਿਹੜੇ ਬੇਮਿਸਾਲ ਨੇਤਾ ਨੇਤਾਵਾਂ ਨੇ ਨੇਤਾ ਸੀਗੇ ਜਿਵੇਂ ਕਿ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ